ਦਸਤ ਦੇ ਇਲਾਜ ਲਈ ਪਿੰਡ ਵਿੱਚ ਕਈ ਨੁਸਖੇ ਪ੍ਰਸਿੱਧ ਨੇ ਅ ਅਲੱਗ ਅਲੱਗ ਪਿੰਡਾਂ ਵਿੱਚ ਅਲੱਗ ਅਲੱਗ ਨੁਸਖੇ ਵਰਤੇ ਜਾਂਦੇ ਨੇ ਸਾਡੇ ਪਿੰਡ ਵਿੱਚ ਜਿਹੜੇ ਦਸਤ ਦੇ ਇਲਾਜ ਲਈ ਆਮ ਘਰਾਂ ਵਿੱਚ ਘਰੇਲੂ ਨੁਸਖੇ ਜਿਹੜੇ ਵਰਤੇ ਜਾਂਦੇ ਨੇ ਉਹਨਾਂ 'ਚੋਂ ਇੱਕ ਤਾਂ ਹੈ ਈਸਵਗੋਲ ਈਸਵਗੋਲ ਦੇ ਪਾਊਡਰ ਨੂੰ ਠੰਡੇ ਪਾਣੀ ਵਿੱਚ ਘੋਲ ਕੇ ਗਲਾਸ ਪਾਣੀ ਦੇ ਵਿੱਚ ਚਮਚਾ ਕੁ ਘੋਲ ਕੇ ਉਹ ਬੰਦੇ ਨੂੰ ਦਿੱਤਾ ਜਾਂਦਾ ਜਿਹਨੂੰ ਦਸਤ ਲੱਗੇ ਹੋਣ ਅਤੇ ਇਸ ਤਰ੍ਹਾਂ ਮਤਲਬ ਚਾਰ ਕੁ ਘੰਟਿਆਂ ਬਾਅਦ ਦੁਬਾਰਾ ਦੇਣਾ ਹੁੰਦਾ ਇਸ ਨਾਲ ਵੀ ਦਸਤ ਠੀਕ ਹੋ ਜਾਂਦੇ ਨੇ ਦੂਜਾ ਨੁਸਖਾ ਜਿਹੜਾ ਆਮ ਤੌਰ 'ਤੇ ਪਿੰਡ ਵਿੱਚ ਵਰਤਿਆ ਜਾਂਦਾ ਆ ਉਹ ਇੱਕ ਚਮਚਾ ਜੀਰੇ ਦਾ ਲੈ ਲਓ ਇਕ ਲੀਟਰ ਪਾਣੀ ਦਾ ਲੈ ਲਓ ਉਹ ਪਾਣੀ 'ਚ ਜੀਰੇ ਦਾ ਚਮਚਾ ਪਾ ਕੇ ਉਹਨੂੰ ਉਬਾਲ ਲਓ ਉੱਬਲਣ ਤੋਂ ਬਾਅਦ ਉਹਨੂੰ ਠੰਡਾ ਕਰ ਲਓ ਠੰਡਾ ਕਰਕੇ ਇਹ ਪੈ ਪਾਣੀ ਜਿਸ ਨੂੰ ਦਸਤ ਲੱਗੀ ਹੋਵੇ ਉਸ ਨੂੰ ਦੇਣਾ ਹੁੰਦਾ ਹੈ ਘੰਟੇ ਘੰਟੇ ਬਾਅਦ ਦੇ ਲਓ ਦੋ ਘੰਟਿਆਂ ਬਾਅਦ ਦੇ ਲਓ ਮਤਲਬ ਉਹਨੂੰ ਬਾਰ ਬਾਰ ਦੇਣ ਦੀ ਕੋਸ਼ਿਸ਼ ਕਰੋ ਇਹਦੇ ਨਾਲ ਵੀ ਦਸਤ 'ਚ ਰਾਹਤ ਮਿਲ ਜਾਂਦੀ ਹੈ ਤੀਸਰਾ ਨੁਸਖਾ ਜਿਹੜਾ ਆਮ ਬੱਚਿਆਂ 'ਤੇ ਵੀ ਵਰਤਿਆ ਜਾਂਦਾ ਹੈ ਵੱਡੇ ਵੀ ਵਰਤ ਸਕਦੇ ਨੇ ਇਹ ਨੁਸਖਾ ਹੁੰਦਾ ਵੀ ਕੇਲਾ ਬਹੁਤ ਅੱਛਾ ਫਲ ਮੰਨਿਆ ਜਾਂਦਾ ਇਹਦੇ ਵਾਸਤੇ ਜਿਸਨੂੰ ਦਸਤ ਲੱਗੇ ਹੋਣ ਉਸ ਨੂੰ ਖਾਣ ਲਈ ਕੇਲਾ ਦਿੱਤਾ ਜਾਂਦਾ ਕੇਲਾ ਖਾਣ ਨਾਲ ਵੀ ਦਸਤ ਦੀ ਸਮੱਸਿਆ ਜਿਹੜੀ ਕਾਫ਼ੀ ਹੱਦ ਤੱਕ ਠੀਕ ਹੋ ਜਾਂਦੀ ਹੈ ਕੇਲੇ ਕੇਲੇ ਦੇ ਸਾਈਜ਼ 'ਤੇ ਡਿਪੈਂਡ ਕਰਦਾ ਛੋਟਾ ਕੇਲਾ ਤਾਂ ਦੋ ਵੀ ਖਾ ਸਕਦੇ ਹੋ ਵੱਡਾ ਕੇਲਾ ਜਿਹਨੂੰ ਗਾਡਰ ਕਹਿ ਦਿੰਦੇ ਨੇ ਉਹ ਇੱਕ ਵੀ ਖਾਧਾ ਜਾ ਸਕਦਾ ਇਹਦੇ ਨਾਲ ਵੀ ਦਸਤ ਦੇ ਵਿੱਚ ਕਾਫ਼ੀ ਰਾਹਤ ਮਿਲਦੀ ਹੈ ਅਤੇ ਦੂਸਰੀ ਗੱਲ ਇਹ ਹੈ ਵੀ ਦਸਤ ਵੇਲੇ ਬੰਦੇ ਦੇ ਪਾਣੀ ਦੀ ਘਾਟ ਵੀ ਹੋ ਸਕਦੀ ਹੈ ਸਰੀਰ ਵਿੱਚੋਂ ਕਿਉਂਕਿ ਪਾਣੀ ਨਿਕਲਦਾ ਜ਼ਿਆਦਾ ਲੂਜ਼ ਮੋਸ਼ਨ ਲੱਗੇ ਹੋਣ ਜ਼ਿਆਦਾ ਦਸਤ ਲੱਗੇ ਹੋਣ ਤਾਂ ਉਹ ਪਾਣੀ ਦੀ ਕਮੀ ਦੂਰ ਕਰਨ ਵਾਸਤੇ ਜਿਹੜਾ ਆਮ ਤੌਰ 'ਤੇ ਨੁਸਖਾ ਵਰਤਿਆ ਜਾਂਦਾ ਉਹ ਇਹ ਹੁੰਦਾ ਵੀ ਪਾਣੀ ਨੂੰ ਉਬਾਲ ਲੈਂਦੇ ਨੇ ਸਿੰਪਲ ਪਾਣੀ ਨੂੰ ਉਬਾਲ ਕੇ ਠੰਡਾ ਕਰ ਲੈਂਦੇ ਨੇ ਫਿਰ ਉਸ ਵਿੱਚ ਥੋੜ੍ਹਾ ਜਿਹਾ ਨਮਕ ਘੋਲਿਆ ਜਾਂਦਾ ਹੈ ਅਤੇ ਚਮਚਾ ਕੁ ਚੀਨੀ ਦਾ ਖੰਡ ਦਾ ਘੋਲਿਆ ਜਾਂਦਾ ਹੈ ਉਹਨੂੰ ਘੋਲ ਕੇ ਇੱਕ ਐਂ ਕਹਿ ਲਓ ਵੀ ਓ ਆਰ ਐੱਸ ਤਿਆਰ ਹੋ ਜਾਂਦਾ ਇੱਕ ਤਰੀਕੇ ਦਾ ਉਹ ਥੋੜ੍ਹੇ ਥੋੜ੍ਹੇ ਚਿਰ ਬਾਅਦ ਦਸਤ ਵਾਲੇ ਬੰਦੇ ਨੂੰ ਜਾਂ ਬੱਚੇ ਨੂੰ ਉਹ ਪਿਲਾਇਆ ਜਾਂਦਾ ਤਾਂ ਕਿ ਸਰੀਰ ਵਿੱਚੋਂ ਪਾਣੀ ਦੀ ਜ਼ਿਆਦਾ ਘਾਟ ਨਾ ਹੋ ਜਾਵੇ ਪਾਣੀ ਦੀ ਘਾਟ ਦੂਰ ਕਰਨ ਲਈ ਇਹ ਘਰੇਲੂ ਓ ਆਰ ਐਸ ਆ ਜਿਹੜਾ ਉਹ ਪਿਲਾਇਆ ਜਾਂਦਾ ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਰਹਿੰਦੀ